ਟੈਕਨੋਲਜੀ ਦੇ ਆਉਣ ਦੇ ਕਾਰਨ ਸਾਡੇ ਪੰਜਾਬੀ ਭਾਸ਼ਾ ਬਹੁਤ ਪੰਜਾਬੀ ਭਾਸ਼ਾ ਦੀ ਵਿਕਸਿਤ ਬਹੁਤ ਘੱਟਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਲੋਕ ਲਿਖਣਾ ਪਸੰਦ ਨਹੀਂ ਕਰਦੇ ਹਨ ਬਸ ਟਾਈਪ ਕਰਨਾ ਪਸੰਦ ਕਰਦੇ ਹਨ ਅਤੇ ਜਿਸ ਦੇ ਕਾਰਨ ਲੋਕਾਂ ਨੂੰ ਇੱਕ ਮੈਸੇਜ ਨਾਲ ਸਭ ਕੁਛ ਪਤਾ ਚੱਲ ਜਾਂਦਾ ਹੈ ਅਤੇ ਪਹਿਲਾਂ ਦੇ ਸਮੇਂ ਦੇ ਵਿੱਚ ਲੋਕ ਚਿੱਠੀਆਂ ਲਿਖਦੇ ਹਨ ਅਤੇ ਅੱਜ ਦੇ ਟਾਈਮ 'ਚ ਟੈਕਨੋਲਜੀ ਕਾਰਨ ਕੋਈ ਇੱਦਾਂ ਦੇ ਕੰਮ ਨਹੀਂ ਕਰਦਾ ਹੈ ਅਤੇ ਜਿਸ ਕਾਰਨ ਸਾਡੇ ਪੰਜਾਬੀ ਦੀ ਬੋਲੀ ਘੱਟਦੀ ਜਾ ਰਹੀ ਹੈ ਅਤੇ ਅੱਜ ਦੇ ਟਾਈਮ ਦੇ ਵਿੱਚ ਲੋਕ ਇੰਗਲਿਸ਼ ਜ ਜ਼ਿਆਦਾ ਯੂਜ ਕਰਦੇ ਹਨ ਅਤੇ ਇੰਗਲਿਸ਼ ਦੇ ਦਸ ਵਰਡ ਬੋਲਦੇ ਹਨ ਅਤੇ ਪੰਜਾਬੀ ਹਿੰਦੀ ਬਹੁਤ ਘੱਟ ਬੋਲਦੇ ਹਨ ਅਤੇ ਇਹ ਮੈਨੂੰ ਬਹੁਤ ਮਹਿਸੂਸ ਹੁੰਦਾ ਹੈ ਕਿ ਸਾਡੇ ਪੰਜਾਬੀ ਬੋਲੀ ਬਹੁਤ ਘੱਟਦੀ ਜਾ ਰਹੀ ਹੈ